ਅੰਮ੍ਰਿਤਸਰ ਜ਼ਿਲ੍ਹੇ ਵਿੱਚ ਆਵਾਜਾਵੀ ਦੇ ਮੁੱਖ ਵਿਕਲਪ ਬੱਸ ਟਰੇਨਾਂ ਹਵਾਈ ਟ੍ਰੇਨਾਂ ਈ ਰਿਕਸ਼ਾ ਆਟੋ ਐਕਟੀਵਾ ਸਕੂਟਰ ਬਾਈਕ ਇਹ ਸਭ ਹਨ ਅਤੇ ਇਹ ਹੈ ਅਤੇ ਵਿਕਲਪ ਸਸਤੇ ਹਨ ਔਰ ਇੱਕ ਤਾਂ ਇਹਨਾਂ ਦੇ ਆਵਾਜਾਈ ਦੇ ਸਾਧਨਾਂ ਨਾਲ ਸਾਨੂੰ ਬੜਾ ਫਾਇਦਾ ਹੈ ਕਿ ਸਾਨੂੰ ਇੱਧਰ ਉੱਧਰ ਜਾਣ ਵਾਸਤੇ ਪੈਦਲ ਭਟਕਣਾ ਨਹੀਂ ਪੈਂਦਾ ਸਾਡੇ ਕੋਲ ਸਾਧਨ ਇੰਨੇ ਆ ਕਿ ਅਸੀਂ ਜੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਤਾਂ ਅਸੀਂ ਆ ਜਾ ਸਕਦੇ ਹਾਂ ਆਸਾਨੀ ਨਾਲ ਪਰ ਇੱਕ ਆਮ ਆਦਮੀ ਲਈ ਇਹ ਵਿਕਲਪ ਸਸਤੇ ਵੀ ਹਨ ਅਤੇ ਮਹਿੰਗੇ ਵੀ ਹਨ ਕੋਈ ਲੈ ਤਾਂ ਸਕਦਾ ਹੈ ਲੇਕਿਨ ਕਦੇ ਕਦੇ ਉਹ ਪੈਟਰੋਲ ਦੇ ਰੇਟ ਇੰਨੇ ਕੁ ਮਹਿੰਗੇ ਹਨ ਕਿ ਉਹਨਾਂ ਨੂੰ ਲੈਣ ਤੋਂ ਹੀ ਝਿਜਕਦਾ ਹੈ ਕਿ ਇਹ ਵੀ ਇੱਕ ਰੋਜ਼ ਦਾ ਹੀ ਸਾਡੇ ਲਈ ਖਰਚਾ ਵੱਧ ਜਾਣਾ ਹੈ ਕਿਉਂਕਿ ਆਮ ਆਦਮੀ ਹੈਂਡ ਟੂ ਮਾਊਥ ਹੀ ਹੁੰਦਾ ਹੈ ਕਿਉਂਕਿ ਉਹ ਇੰਨਾ ਕੁ ਨਹੀਂ ਕਮਾ ਸਕਦਾ ਕਿ ਹਰ ਰੋਜ਼ ਪੈਟਰੋਲ ਦੇ ਖਰਚੇ ਵੀ ਇੰਨੇ ਕੁ ਕੱਢ ਸਕਣ ਬਾਕੀ ਆਵਾਜਾਵੀ ਦੇ ਸਾਧਨ ਇੰਨੇ ਕੁ ਵੱਧ ਗਏ ਆ ਅੰਮ੍ਰਿਤਸਰ ਵਿੱਚ ਕਈਆਂ ਨੂੰ ਤਾਂ ਜਾਂਦੇ ਹੀ ਡਰ ਲੱਗਦਾ ਹੈ ਕਿਉਂਕਿ ਅੱਜ ਕੱਲ੍ਹ ਜਿਹੜੇ ਈ ਰਿਕਸ਼ਾ ਹੈ ਇਹ ਕੋਈ ਆਵਾਜ਼ ਨਹੀਂ ਕਰਦਾ ਕਦੇ ਮੋੜ ਕੱਟਦਾ ਕੁਛ ਨਹੀਂ ਪਤਾ ਲੱਗਦਾ ਵੀ ਪਿੱਛੋਂ ਕੀ ਆ ਰਿਹਾ ਕੀ ਨਹੀਂ ਔਰ ਜਾਂਦੇ ਜਾਂਦੇ ਪੈਦਲ ਚਲਦੇ ਇਨਸਾਨ ਵਿੱਚ ਵੀ ਠੋਕ ਜਾਂਦਾ ਹੈ ਕਈ ਤਾਂ ਇੰਨਾਂ ਕੁ ਆਵਾਜਾਈ ਦੇ ਸਾਧਨਾ ਤੋਂ ਡਰਦੇ ਆ ਕਿ ਉਹ ਬਾਹਰ ਹੀ ਨਹੀਂ ਨਿਕਲਣਾ ਚਾਹੁੰਦੇ ਕਿ ਸਾਡੇ ਵਿੱਚ ਕੋਈ ਠੋਕ ਹੀ ਨਾ ਜਾਵੇ ਕਿਉਂਕਿ ਇਹਦੇ ਨਾਲ ਇੱਕ ਤਾਂ ਆ ਪਲਿਊਸ਼ਨ ਬੜਾ ਕਰਦੇ ਆਵਾਜਾਈ ਦੇ ਸਾਧਨ ਕਈਆਂ ਨੂੰ ਸਾਹ ਦੀ ਪ੍ਰੋਬਲਮ ਅਸਥਮਾ ਦੀ ਪ੍ਰੋਬਲਮ ਹੋ ਰਹੀ ਹੈ ਬਾਕੀ ਜਿੱਥੇ ਇੱਕ ਫਾਇਦਾ ਵੀ ਆ ਅਤੇ ਇੱਕ ਨੁਕਸਾਨ ਵੀ ਹਰ ਇੱਕ ਚੀਜ਼ ਨਾਲ ਜੁੜਿਆ ਹੁੰਦਾ ਵੈ ਆਵਾਜਾਈ ਦੇ ਸਾਧਨਾਂ ਨਾਲ ਸਾਨੂੰ ਸੁਵਿਧਾ ਵੀ ਕਾਫੀ ਹੈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਵਾਸਤੇ ਸਾਨੂੰ ਕਿਸੇ ਦੇ ਮੂੰਹ ਵੱਲ ਨਹੀਂ ਵੇਖਣਾ ਪੈਂਦਾ ਅਤੇ ਬਾਕੀ ਇਨਦੇ ਨੈਗਟਿਵ ਪੁਆਇੰਟ ਵੀ ਹੈ ਕਿ ਇਨਦੇ ਨਾਲ ਪਲਿਊਸ਼ਨ ਵੱਧ ਰਿਹਾ ਲੋਕਾਂ ਨੂੰ ਸਾਹ ਦੀਆਂ ਬਿਮਾਰੀਆਂ ਅਸਥਮਾ ਦੀਆਂ ਬਿਮਾਰੀਆਂ ਆ ਰਹੀਆਂ ਹੈ ਲੋਕ ਅੰਨੇ ਵਾ ਚਲਾਉਂਦੇ ਹੈ ਕਈ ਕਹਿੰਦੇ ਆ ਕਿ ਬਸ ਅਸੀਂ ਅੱਗੇ ਨਿਕਲ ਜਾਈਏ ਬਾਕੀ ਪਿੱਛੇ ਆਦਮੀ ਰਹਿੰਦਾ ਤਾਂ ਰਹੀ ਜਾਵੇ